ਮੇਰੇ ਦੁਆਰਾ ਡਾਊਨਲੋਡ ਕੀਤੀ ਗਈ ਆਖਰੀ ਐਪ ਇੰਸਟਾਗਰਾਮ ਹੈ ਇਹਨੂੰ ਮੈਨੂੰ ਇਹਦੇ ਵਿੱਚ ਇਹ ਪਸੰਦ ਹੈ ਕਿ ਇਹਦੇ ਵਿੱਚ ਅਸੀਂ ਰੀਲਾਂ ਬਣਾ ਸਕਦੇ ਹਾਂ ਅਸੀਂ ਲੋਕਾਂ ਨੂੰ ਰੀਲਾਂ ਸ਼ੇਅਰ ਕਰ ਸਕਦੇ ਹਾਂ ਜੋ ਕਿ ਇੱਕ ਮਨੋਰੰਜਨ ਦਾ ਸਾਧਨ ਹੈ ਬਹੁਤ ਵਧੀਆ ਸਾਧਨ ਹੈ ਇਹਦੇ ਵਿੱਚ ਸਾਨੂੰ ਜਾਣਕਾਰੀ ਬਹੁਤ ਮਿਲਦੀ ਹੈ ਜਿੱਦਾਂ ਕਿ ਰਸੋਈ ਨਾਲ ਸੰਬੰਧਿਤ ਅਸੀਂ ਵੱਖਰੀਆਂ ਵੱਖਰੀਆਂ ਚੀਜ਼ਾਂ ਖਾਣ ਪੀਣ ਨੂੰ ਦੀਆਂ ਚੀਜ਼ਾਂ ਬਣਾਉਂਦੇ ਹਾਂ ਉਹਦੇ ਨਾਲ ਸੰਬੰਧਿਤ ਸਾਨੂੰ ਬਹੁਤ ਜਾਣਕਾਰੀ ਮਿਲ ਜਾਂਦੀ ਆ ਇਸ ਨੂੰ ਐਪ ਨੂੰ ਲੋਕ ਅੱਜ ਕੱਲ੍ਹ ਆਪਣੀ ਬਿਜ਼ਨਸ ਦੇ ਲਈ ਵਰਤਦੇ ਨੇ ਆਪਣਾ ਉਹ ਪੈਸੇ ਕਮਾਉਣ ਦਾ ਇੱਕ ਜ਼ਰੀਆ ਬਣਾਇਆ ਹੋਇਆ ਲੋਕਾਂ ਨੇ ਔਰ ਇਹਦੇ ਵਿੱਚ ਅਸੀਂ ਬੂੰਮਰੈਂਗ ਨਾਮਕ ਇੱਕ ਆਉਂਦੀ ਹੈ ਸੁਵਿਧਾ ਉਪਲਬਧ ਹੈ ਜਿਸ ਵਿੱਚ ਲੋਕ ਆਪਣੀ ਜ਼ਿੰਦਗੀ ਨੂੰ ਲੋਕਾਂ ਨਾਲ ਸ਼ ਸਾਂਝਾ ਕਰਦੇ ਨੇ ਇੱਕ ਦੂਸਰੇ ਅਸੀਂ ਇੱਕ ਦੂਸਰੇ ਅਸੀਂ ਕਿਤੇ ਵੀ ਜਾਈਏ ਅਸੀਂ ਉਹਦੀ ਰੀਲ ਬਣਾ ਸਕਦੇ ਹਾਂ ਅਸੀਂ ਲੋਕਾਂ ਨੂੰ ਦਿਖਾ ਸਕਦੇ ਹਾਂ ਕਿ ਹਾਂ ਅਸੀਂ ਇੱਥੇ ਇਸ ਥਾਂ 'ਤੇ ਖੜੇ ਹਾਂ ਅਸੀਂ ਅੱਜ ਇੱਥੇ ਘੁੰਮ ਰਹੇ ਹਾਂ ਮਤਲਬ ਬਹੁਤ ਇੱਕ ਵਧੀਆ ਐਪ ਹੈ ਮੈਨੂੰ ਇਹਦੇ ਵਿੱਚ ਜ਼ਿਆਦਾ ਇਹੀ ਚੀਜ਼ ਪਸੰਦ ਹੈ ਕਿ ਅਸੀਂ ਇਹਦੇ ਵਿੱਚ ਰੀਲਾਂ ਸ਼ੇਅਰ ਕਰ ਸਕਦੇ ਹਾਂ ਮੰਨੋਰੰਜਨ ਕਰ ਸਕਦੇ ਹਾਂ ਵੱਖ ਵੱਖ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਰਸੋਈ ਨਾਲ ਸੰਬੰਧਿਤ ਸਿਲਾਈ ਨਾਲ ਸੰਬੰਧਿਤ ਸਪੋਰਟਸ ਨਾਲ ਸੰਬੰਧਿਤ ਕਾਫੀ ਤਰੀਕੇ ਦੀ ਮਤਲਬ ਕਿ ਜ਼ਿੰਦਗੀ ਦੇ ਹਰ ਖੇਤਰ ਦੀ ਜਾਣਕਾਰੀ ਇੱਥੇ ਸਾਨੂੰ ਉਪਲਬਧ ਮਿਲ ਜਾਂਦੀ ਹੈ ਮਨੋਰੰਜਨ ਦਾ ਇੱਕ ਬਹੁਤ ਵਧੀਆ ਸਾਧਨ ਹੈ ਅਤੇ ਨਾਲ ਹੀ ਮੇਰੇ ਐਪ ਵਿੱਚ ਇਸ ਤੋਂ ਇਲਾਵਾ ਬਹੁਤ ਐਪ ਹੈ ਸਨੈਪਚੈਟ ਹੈ ਯੂਟਿਊਬ ਹੈ ਗੂਗਲ ਪੇ ਹੈ ਸਪੋਟੀਫਾਈ ਆ ਨੈਟਫਲਿਕਸ ਹੈ ਇਹ ਵਾਲੀਆਂ ਐਪ ਆ ਜਿਹਨਾਂ ਦੀ ਅਸੀਂ ਵਰਤੋਂ ਕਰਦੇ ਹਾਂ ਇਹਨਾਂ ਦੀ ਸਨੈਪਚੈਟ ਦੀ ਵਰਤੋਂ ਇਹਦੇ ਵਿੱਚ ਸਟੀਕ ਹੁੰਦੀਆਂ ਅਸੀਂ ਸਟੀਕ ਇਹ ਵੀ ਸਾਨੂੰ ਜੋੜੇ ਰੱਖਦਾ ਆਪਸ ਵਿੱਚ ਵਟਸਐਪ ਹੈ ਇਹ ਸਾਰੀਆਂ ਐਪ ਸਾਨੂੰ ਆਪਸ ਵਿੱਚ ਜੋੜੇ ਰੱਖਦੀਆਂ ਇੱਕ ਦੂਸਰੇ ਨਾਲ ਅਸੀਂ ਦੂਸਰੇ ਨੂੰ ਵੀਡੀਓ ਕੌਲ ਕਰ ਸਕਦੇ ਹਾਂ ਅਸੀਂ ਇੱਕ ਦੂਸਰੇ ਨੂੰ ਕਿਤੇ ਵੀ ਬੈਠੇ ਇੱਕ ਦੂਸਰੇ ਨਾਲ ਜੁੜ ਸਕਦੇ ਹਾਂ ਅਸੀਂ ਇੱਕ ਦ ਇੱਕ ਦੂਸਰੇ ਨੂੰ ਦੇਖ ਸਕਦੇ ਹਾਂ ਔਰ ਯੂਟੀਊਬ ਵਿੱਚ ਵੀ ਅਸੀਂ ਭਜਨ ਸੁਣ ਸਕਦੇ ਹਾਂ ਅਧਿਆਤਮਿਕ ਤੌਰ 'ਤੇ ਵੀ ਯੂਟੀਊਬ ਸਾਨੂੰ ਜੋੜੇ ਰੱਖਦਾ ਹੈ ਉਸ ਪਰਮਾਤਮਾ ਦੇ ਨਾਲ ਉਸ ਦੇ ਵਿੱਚ ਅਸੀਂ ਭਜਨ ਸੁਣ ਸਕਦੇ ਹਾਂ ਗਾਣੇ ਸੁਣ ਸਕਦੇ ਹਾਂ ਉਹਦੇ ਵਿੱਚ ਵੀ ਸਾਨੂੰ ਮੰਨੋਰੰਜਨ ਦਾ ਬਹੁਤ ਵਧੀਆ ਇੱਕ ਸਾਧਨ ਹੈ ਉਹ ਵੀ ਉਹਦੇ ਵਿੱਚ ਅਸੀਂ ਯੂਟੀਊਬ ਦੇ ਵਿੱਚ ਵੀ ਅਸੀਂ ਜਿੱਦਾਂ ਕਿ ਪੇਜ਼ ਬਣੇ ਹੁੰਦੇ ਆ ਲੋਕਾਂ ਨੇ ਪੇਜ਼ ਬਣਾਏ ਹੋਏ ਆ ਸਾਨੂੰ ਬਹੁਤ ਸਾਰੀ ਸਮੱਗਰੀ ਬਹੁਤ ਸਾਰੀ ਜਾਣਕਾਰੀ ਮਿਲਦੀ ਆ ਜਿੱਦਾਂ ਕਿ ਸਿਲਾਈ ਨਾਲ ਸੰਬੰਧਿਤ ਉਹਦੇ ਵਿੱਚ ਵੀ ਜਿੱਦਾਂ ਰਸੋਈ ਨਾਲ ਸੰਬੰਧਿਤ ਸਪੋਰਟਸ ਨਾਲ ਸੰਬੰਧਿਤ ਦੇਸ਼ ਦੁਨੀਆ ਦੀਆਂ ਖਬਰਾਂ ਇੰਟਰਨੈਸ਼ਨਲ ਖਬਰਾਂ ਵੀ ਸਾਨੂੰ ਉਹਦੇ ਵਿੱਚ ਮਿਲਦੀਆਂ ਨੇ ਯੂਟੀਊਬ ਵਿੱਚ ਅਸੀਂ ਪ੍ਰਾਪਤ ਕਰ ਸਕਦੇ ਹਾਂ ਮਤਲਬ ਕਿ ਇਹ ਐਪ ਜੋ ਹੈ ਸਾਡੀ ਲਾਈਫ ਜ਼ਿੰਦਗੀ ਦੇ ਵਿੱਚ ਇਹ ਜ਼ਰੂਰੀ ਹੈ ਕਿ ਸਾਨੂੰ ਇਹ ਬਹੁਤ ਸਾਰੀ ਜਾਣਕਾਰੀ ਵੀ ਪ੍ਰਦਾਨ ਕਰਦੇ ਨੇ ਅਤੇ ਇੱਕ ਤਰੀਕੇ ਦਾ ਇਹ ਇੱਕ ਮਨੋਰੰਜਨ ਦਾ ਸਾਧਨ ਆ ਇਹਨਾਂ ਨੇ ਸਾਡੀ ਜ਼ਿੰਦਗੀ ਬਹੁਤ ਆਸਾਨ ਬਣਾ ਦਿੱਤੀ ਸਰਲ ਬਣਾ ਦਿੱਤੀ ਹੋਈ ਆ ਧੰਨਵਾਦ